ਹਾਂਜੀ ਧਰਮ ਦੇ ਨਾਮ 'ਚ ਬਹੁਤ ਜ਼ਿਆਦਾ ਅੰਧ ਵਿਸ਼ਵਾਸ ਜਿਹੜਾ ਹੈ ਉਹ ਚੱਲ ਰਿਹਾ ਹੈ ਭਾਰਤ ਦੇ ਵਿੱਚ ਜਿੱਦਾਂ ਕਿ ਅਸੀਂ ਦੇਖਿਆ ਹੈ ਅੰਧ ਵਿਸ਼ਾ ਆ ਅੰਧ ਵਿਸਵਾਸ਼ਾਂ ਦੇ ਨਾਲ ਜਿਹੜਾ ਇਹ ਕਿ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਵਿਸ਼ਵਾਸ ਕਰਦੇ ਨੇ ਬਾਬਿਆਂ ਦੇ ਪਿੱਛੇ ਲੱਗ ਜਾਂਦੇ ਨੇ ਅਤੇ ਆਪਣਾ ਮਲ ਪੈਸੇ ਪੂਸੇ ਸਭ ਠੱਗ ਕੇ ਅਤੇ ਜਿਹੜੇ ਆ ਜਾਂਦੇ ਵੀ ਸਾਡਾ ਕੰਮ ਬਣੇਗਾ ਸਾਡੇ ਜੀਵਨ 'ਚ ਤਰੱਕੀ ਹੋਵੇਗੀ ਪਰ ਇਹੋ ਜਿਹਾ ਹੁੰਦਾ ਕੁਛ ਨਹੀਂ ਹੈਗਾ ਇਹੋ ਜਿਹੇ ਬਾਬਿਆਂ ਨੇ ਵੀ ਅਤੇ ਆਪਣੇ ਡੇਰੇ ਬਣਾ ਰੱਖੇ ਨੇ ਜਿਸ ਤਰ੍ਹਾਂ ਕਿ ਬਾਬਾ ਰਾਮ ਰਹੀਮ ਹੋ ਗਿਆ ਬਾਬਾ ਆਸਾ ਰਾਮ ਹੋ ਗਈ ਉਹਨਾਂ ਪਿੱਛੇ ਅਸੀਂ ਵੇਖਦੇ ਸਾਂ ਵੀ ਕਿੰਨੀ ਕਿੰਨੀ ਜਿਹੜੀ ਸੰਗਤ ਉਹਨਾਂ ਦੇ ਮਗਰ ਲੋਕ ਉਹਨਾਂ ਦੇ ਮਗਰ ਜ ਐਜ ਸੰਗਤ ਲੱਗੇ ਹੋਏ ਸਨ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ ਕਿਉਂਕਿ ਉਹ ਐ ਗੁਰੂ ਦੇ ਗੁਰੂ ਧਾਰਨ ਕੀਤਾ ਹੋਇਆ ਸੀ ਲੋਕਾਂ ਨੇ ਉਹਨਾਂ ਨੂੰ ਆਪਣਾ ਅਤੇ ਉਹਨਾਂ ਨੂੰ ਮਤਲਬ ਉਹ ਮੱਥਾ ਟੇਕ ਕੇ ਹੀ ਆਪਣਾ ਹਰ ਕੰਮ ਕਰਦੇ ਸੀ ਅਤੇ ਕਿੰਨਾ ਕਿੰਨਾ ਚੜਾਵਾ ਜਿਹੜਾ ਉਹਨਾਂ ਕੋਲ ਚੜਦੇ ਹੁੰਦੇ ਸੀ ਪਰ ਆਖਿਰ ਲੋਕਾਂ ਨੂੰ ਇਹ ਪਤਾ ਲੱਗ ਗਈ ਹੀ ਗਿਆ ਬਾਅਦ ਦੇ ਵਿੱਚ ਕਿ ਇਹ ਸਿਰਫ ਠੱਗ ਜਿਹੜੇ ਆ ਠੱਗ ਬਾਬੇ ਨੇ ਇਹ ਅਸਲੀ ਬਾਬੇ ਨਹੀਂ ਹੈਗੇ ਅਤੇ ਇਸ ਤਰ੍ਹਾਂ ਲੋਕਾਂ ਨੂੰ ਨਾ ਥੋੜ੍ਹਾ ਜਾਗਰੂਕ ਹੋਣਾ ਚਾਹੀਦਾ ਏ ਉਹਨਾਂ ਨੂੰ ਠੱਗ ਬਾਬਿਆਂ 'ਚ ਅਤੇ ਜਿਹੜੇ ਅਸਲ ਬਾਬੇ ਨੇ ਉਹਨਾਂ 'ਚ ਮਤਲਬ ਫਰਕ ਨਜ਼ਰ ਆਉਣਾ ਚਾਹੀਦਾ ਹੈ ਹਰ ਕਿਸੇ ਨੂੰ ਅ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਆਪਣੇ ਆਪ ਨੂੰ ਥੋੜ੍ਹਾ ਜਾਗਰੂਕ ਕਰਨਾ ਚਾਹੀਦਾ ਹੈ ਮੈਂ ਨਹੀਂ ਕਹਿੰਦੀ ਕਿ ਧਰਮ ਦੇ ਨਾਮ 'ਚ ਤੁਸੀਂ ਕੋਈ ਦਾਨ ਨਾ ਕਰੋ ਲੇਕਿਨ ਧਰਮ ਦੇ ਨਾਮ 'ਚ ਤੁਹਾਡਾ ਦਾਨ ਗਲਤ ਹੋਇਆ ਹੈ ਇਹ ਬਹੁਤ ਹੀ ਚੰਗੀ ਗੱਲ ਨਹੀਂ ਹੈਗੀ ਚੰਗੀ ਗੱਲ ਇਹ ਇਸ ਲਈ ਨਹੀਂ ਹੈਗੀ ਕਿਉਂਕਿ ਦੇਖੋ ਜੀ ਤੁਸੀਂ ਆਪਣਾ ਤਾਂ ਆਪਣੇ ਵੱਲੋਂ ਤਾਂ ਤੁਸੀਂ ਚੰਗੀ ਥਾਂ 'ਚ ਦਾਨ ਕਰ ਰਹੇ ਹੋ ਲੇਕਿਨ ਤੁਹਾਡਾ ਦਾਨ ਜਿਹੜਾ ਉਹ ਮਿਸਯੂਜ਼ ਹੋ ਰਿਹਾ ਹੈ ਇਸ ਲਈ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਪਲੀਸ ਕਿਰਪਾ ਕਰਕੇ ਥੋੜ੍ਹਾ ਨਾ ਆਪਣੇ ਆਪ ਨੂੰ ਜਾਗਰੂਕ ਰੱਖੋ